ਹੈਲੋ ਬਰਨਾਲਾ ਕਲੱਬ ਤੋਂ ਬੋਲਦੇ ਹੋ ਜੀ ਹਾਂਜੀ ਸਾਡੇ ਗੁਆਂਢ 'ਚ ਜੀ ਕਿਸੇ ਤੋਂ ਨੰਬਰ ਲਿੱਤਾ ਸੀ ਜੀ ਹਾਂਜੀ ਸਾਡੇ ਦੋ ਬੱਚੇ ਨੇ ਜੀ ਇੱਕ ਲੜਕਾ ਹੈ ਜੀ ਇੱਕ ਬੇ ਲੜਕੀ ਜੀ ਉਹ ਸਕੂਲ ਜਾਂਦੇ ਨੇ ਸਕੂਲ ਤੋਂ ਆ ਕੇ ਮੋਬਾਇਲ ਚੱਕ ਲੈਂਦੇ ਨੇ ਜੀ ਖੇਡਦੇ ਖੂਡਦੇ ਹੈ ਨਹੀਂ ਜੀ ਉਹ ਕੁਛ ਵੀ ਅਤੇ ਅਸੀਂ ਉਹਨਾਂ ਨੂੰ ਖੇਡਾਂ 'ਚ ਪਾਉਣਾ ਚਾਹੁੰਦੇ ਹਾਂ ਜੀ ਤੁਹਾਡੇ

ਹਾਂਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਹਾਂਜੀ

ਹਾਂਜੀ ਬੇਟੇ ਬੇਟੇ ਨੂੰ ਜੀ ਡਾਂਸ ਕਰਨਾ ਵੀ ਬਹੁਤ ਪਸੰਦ ਹੈ ਜੀ ਉਹਨੂੰ ਡਾਂਸ ਸਿਖਾ ਦੇਣਾ ਜੀ ਹਾਂਜੀ ਹਾਂਜੀ ਹਾਂਜੀ ਜਿਵੇਂ ਕਿ ਲੜਕੀ ਨੂੰ ਜੀ ਕਰਾਟੇ ਜੀ ਬਾਣੀਏ ਦੇ ਵਿੱਚ ਚੱਲਦੇ ਨੇ ਜੀ ਬਹੁਤ ਮਸ਼ਹੂਰ ਨੇ ਜੀ ਉਹ ਕਰਵਾ ਦਵਾਂਗੇ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਤੁਹਾਡਾ ਟਾਈਮ ਜੀ ਕਿੰਨੇ ਤੋਂ ਕਿੰਨਾ ਜੀ ਫੇਰ ਜੀ ਟਾਈਮ ਜੀ ਪੰਜ ਪੰਜ ਓਕੇ ਸਵੇਰੇ ਆਵਾਂਗੇ ਜੀ ਥੈਂਕ ਯੂ ਜੀ ਥੈਂਕ ਥੈਂਕ